ਹਾਂਜੀ ਇਕ ਅਜਿਹਾ ਮੇਰਾ ਦੋਸਤ ਜਿਸ ਦਾ ਨਾਮ ਲਵਪ੍ਰੀਤ ਸਿਘ ਬੈਂਸ ਹੈ ਅਤੇ ਉਹਨਾਂ ਨੇ ਬੀ ਏ ਦੀ ਡਿਗਰੀ ਲਿੱਤੀ ਬੀ ਏ ਤੋਂ ਬਾਅਦ ਡੀ ਪੀ ਐਡ ਬੀ ਪੀ ਐਡ ਕੀਤੀ ਪਟਿਆਲਾ ਤੋਂ ਅਤੇ ਵੈਸੇ ਵੀ ਮੈਨੂੰ ਜਾਣ ਪਛਾਣ ਦਾ ਹੈ ਅਤੇ ਮੇਰਾ ਦੋਸਤ ਵੀ ਵਧੀਆ ਹੈ ਉਹ ਪੀ ਪੀ ਐਡ ਬੀ ਪੀ ਐਡ ਕਰਨ ਤੋਂ ਬਾਅਦ ਉਹਨਾਂ ਨੇ ਮਾਲਵਾ ਕਾਲਜ ਦੇ ਵਿੱਚ ਪ੍ਰਾਈਵੇਟ ਜੋਬ ਕੀਤੀ ਹੈ ਕਾਫ਼ੀ ਟਾਈਮ ਅਤੇ ਜੋਬ ਕਰਨ ਤੋਂ ਬਾਅਦ ਉਹਨਾਂ ਨੇ ਫਿਜੀਕਲ ਟੈਸਟ ਕਲੀਅਰ ਕੀਤੇ ਫਿਜੀਕਲ ਟੈਸਟ ਕਰਨ ਤੋਂ ਬਾਅਦ ਉਹਨਾਂ ਨੂੰ ਡੀ ਪੀ ਮਾਸਟਰ ਦੀ ਪੋਸਟ ਦੇ ਉੱਤੇ ਸਿਲੈਕਸ਼ਨ ਹੋਈ ਹੈ ਉਹਨਾਂ ਦੀ ਤਾਂ ਬਹੁਤ ਹੀ ਵਧੀਆ ਤਰੀਕੇ ਨਾਲ ਹੁਣ ਆਪਣੀ ਜੋਬ ਕਰ ਰਹੇ ਨੇ ਉਹ ਅਤੇ ਕਾਫ਼ੀ ਮਿਹਨਤ ਵੀ ਕੀਤੀ ਹੈ ਉਹਨਾਂ ਨੇ ਇਸ ਕੰਮ ਦੇ ਵਿੱਚ ਡੀ ਪੀ ਐਡ ਬੀ ਪੀ ਐਡ ਦੇ ਵਿੱਚ ਡਿਗਰੀ ਹਾਸਲ ਕਰਨ ਦੇ ਵਿੱਚ ਕਾਫ਼ੀ ਮਿਹਨਤ ਕੀਤੀ ਜਦੋਂ ਪ੍ਰਾਈਵੇਟ ਜੋਬ ਕੀਤੀ ਉਦੋਂ ਵੀ ਕਾਫ਼ੀ ਮਿਹਨਤ ਦੇ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਸਨ ਅਤੇ ਗੇਮਾਂ ਵਗੈਰਾ ਵੀ ਖਿਡਾਉਂਦੇ ਸਨ ਅਤੇ ਇਸ ਟਾਈਮ ਉਹ ਹੁਣ ਸਰਕਾਰੀ ਸਕੂਲ ਦੇ ਵਿੱਚ ਡੀ ਪੀ ਮਾਸਟਰ ਨੇ ਅਤੇ ਡੀ ਪੀ ਮਾਸਟਰ ਦੀ ਜਿਹੜੀ ਕਿ ਪੋਸਟ 'ਤੇ ਨੇ ਕਾਫ਼ੀ ਚੰਗੇ ਇਨਸਾਨ ਨੇ